ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸ਼ਰਮਾ ਹਾਊਸ ਬੂਟ ਹਾਊਸ ਤੋਂ ਬੋਲਦੇ ਹੋ ਜੀ ਬਰਨਾਲੇ ਤੋਂ ਹਾਂਜੀ ਜੀ ਮੈਂ ਨਾ ਤੁਹਾਥੋਂ ਬੂਟਾਂ ਬਾਰੇ ਪਤਾ ਲੈਣਾ ਸੀ ਥੋੜ੍ਹਾ ਜਿਹਾ ਹਾਂਜੀ ਆਪਣੀ ਦੁਕਾਨ ਕਿੱਥੇ ਕੁ ਹੈ ਜੀ ਪਹਿਲਾਂ ਅੱਛਾ ਜੀ ਅਤੇ ਆਪਣੀ ਵੀ ਕਿਹੜੀ ਕਿਹੜੀ ਕੰਪਨੀ ਦੇ ਬੂਟ ਮਿਲ ਜਾਣਗੇ ਜੀ ਹਾਂ ਬੂਟ ਅੱਛਾ ਜੀ ਬੂਟ ਦੇ ਤਿੰਨ ਚਾਰ ਜੋੜੇ ਲੈਣੇ ਆ ਜੀ ਇੱਕ ਤਾਂ ਵੀ ਹੈ ਨਾ ਪੋਲੇ ਜੇ ਲੈਣੇ ਹੈਗੇ ਭੱਜਣ ਭੁੱਜਣ ਵਾਸਤੇ ਹਾਂਜੀ ਇੱਕ ਮੈਂ ਆਪਦੇ ਪਾਪਾ ਵਾਸਤੇ ਲੈਣੇ ਸੀ ਆਫਿਸ 'ਚ ਪਾਉਣ ਨੂੰ ਲੈਦਰ ਦੇ

ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਜੀ ਤੁਸੀਂ ਜੇ ਮਾਨ ਹਾਂਜੀ ਜੇ ਮੰਨ ਲਓ ਵੀ ਕੋਈ ਪੀਸ 'ਚ ਇਫੈਕਟ ਨਿਕਲ ਗਿਆ ਜੀ ਥੋੜ੍ਹਾ ਜਿਹਾ ਉਹ ਰਿਟਰਨ ਹੋਜੇਗਾ ਉਹ ਕਿਹੜੇ ਬੂਟ ਹੋਣਗੇ ਜੀ ਵੀ ਉਹ ਰੀਜਨਲ ਹੋਣਗੇ ਕਿ ਫਸਟ ਕਾਪੀ ਨੇ ਜੀ ਅੱਛਾ ਜੀ ਸਾਨੂੰ ਵੀ ਪਤਾ ਜੀ ਸਾਡੇ ਨਾਲ ਅਵ ਅਵਤਾਰ ਜੈਲਦਾਰ ਉਹਨਾਂ ਦੇ ਵਿਆਹ ਸੀਗਾ ਹੈ ਨਾ ਜੀ ਅਤੇ ਉਹਨਾਂ ਨੇ ਸਾਨੂੰ ਦਿੱਤਾ ਤੁਹਾਡਾ ਪਤਾ ਵੀ ਉਹਨਾਂ ਨੇ ਜੁੱਤੀਆਂ ਬਹੁਤ ਘੈਂਟ ਪਾਈਆਂ ਵੀਆਂ ਸੀਗੀਆਂ ਅੱਛਾ ਜੀ ਚਲੋ ਮੈਂ ਮਾਰਦਾ ਜੀ ਆਹ ਕੱਲ੍ਹ ਤੱਕ ਗੇੜਾ ਦੁਕਾਨ 'ਤੇ ਠੀਕ ਹੈ